ਮੇਰਾ ਓਨਲਾਈਨ ਖਰੀਦਦਾਰੀ ਦਾ ਤਜਰਬਾ ਬਹੁਤ ਹੀ ਸਕਾਰਾਤਮਕ ਸੀ ਸਟੋ ਦੀ ਵੈਬਸਾਈਟ ਬੜੀ ਸੁਚੱਜੀ ਅਤੇ ਆਸਾਨੀ ਨਾਲ ਵਰਤਣ ਯੋਗ ਸੀ ਕੱਪੜਿਆਂ ਦੀ ਵੱਡੀ ਰੇਂਜ ਅਤੇ ਉੱਚੀ ਗੁਣਵੱਤਾ ਨੇ ਮੈਨੂੰ ਖੁਸ਼ ਕੀਤਾ ਉਹਨਾਂ ਦੇ ਉਦਪਾਦ ਵੇਰਵਿਆਂ ਅਤੇ ਆਕਾਰ ਸਾਰਨੀ ਨਾਲ ਮੈਂ ਬਹੁਤ ਸਹੀ ਤੌਰ 'ਤੇ ਆਪਣੀ ਚੋਣ ਕੀਤੀ ਕਿਵੇਂ ਅਤੇ ਜਦੋਂ ਵੀ ਜ਼ਰੂਰਤ ਪਈ ਸਟੋਰ ਦਾ ਗ੍ਰਾਹਕ ਸੇਵਾ ਟੀਮ ਬਹੁਤ ਮਦਦਗਾਰ ਅਤੇ ਤੁਰੰਤ ਸੰਪਰਕ ਕਰਨ ਵਾਲੀ ਸੀ ਡਲੇਬਰੀ ਵੀ ਸਮੇਂ 'ਤੇ ਹੋਈ ਅਤੇ ਪੈਕੇਜ਼ਿੰਗ ਵੀ ਬਹੁਤ ਧਿਆਨ ਨਾਲ ਕੀਤੀ ਗਈ ਮੇਰੇ ਤਜਰਬੇ ਦੇ ਅਧਾਰ 'ਤੇ ਮੈਂ ਇਸ ਸਟੋ ਨੂੰ ਪੰਜ ਤਾਰੇ ਦਵਾਂਗਾ ਮਤਲਬ ਪੰਜ ਸਟਾਰ ਦਵਾਂਗਾ ਅਤੇ ਓਨਲਾਈਨ ਸ਼ੋਪਿੰਗ ਇੱਕ ਬਹੁਤ ਹੀ ਵਧੀਆ ਚੀਜ਼ ਹੈ ਜਿਵੇਂ ਕਿ ਅਗਰ ਅਸੀਂ ਬਾਜ਼ਾਰ ਨਹੀਂ ਜਾ ਸਕਦੇ ਤਾਂ ਅਸੀਂ ਓਨਲਾਈਨ ਸ਼ੋਪਿੰਗ ਕਰ ਸਕਦੇ ਹਾਂ ਓਨਲਾਈਨ ਕੱਪੜੇ ਮੰਗਾ ਸਕਦੇ ਹਾਂ ਸਾਨੂੰ ਓਨਲਾਈਨ ਵਿੱਚ ਬਹੁਤ ਹੀ ਫਾਇਦਾ ਮਿਲਦਾ ਹੈ ਸਾਡੇ ਟਾਈਮ ਦੀ ਬਚਤ ਹੁੰਦੀ ਹੈ ਅਸੀਂ ਓਨਲਾਈਨ ਸ਼ੋਪਿੰਗ ਕਰਕੇ ਆਰਾਮ ਨਾਲ ਕੱਪੜੇ ਮੰਗਾ ਸਕਦੇ ਹਾਂ ਪਰ ਇਸ ਦਾ ਇੱਕ ਦੁਰ ਡਿਸਅਡਵਾਂਟੇਜ ਵੀ ਹੈ ਜਿਵੇਂ ਕਿ ਸਾਨੂੰ ਗਲਤ ਸਾਈਜ਼ ਜਾਂ ਕੱਪੜੇ ਦੀ ਕੁਆਲਿਟੀ ਦਾ ਪਤਾ ਨਹੀਂ ਲੱਗਦਾ ਕਈ ਵਾਰ ਅਸੀਂ ਓਨਲਾਈਨ ਸ਼ੋਪਿੰਗ ਕਰਦੇ ਹਾਂ ਤਾਂ ਓਰਡਰ ਅਸੀਂ ਕੁਝ ਕਰਦੇ ਹਾਂ ਅਤੇ ਕੱਪੜੇ ਸਾਨੂੰ ਕੁਝ ਮਿਲਦੇ ਹਨ ਉਸ ਦੀ ਕੁਆਲਿਟੀ ਬਹੁਤ ਹੀ ਘਟੀਆ ਹੁੰਦੀ ਹੈ ਫਿਰ ਸਾਨੂੰ ਰਿਟਰਨ ਕਰਕੇ ਨਵੇਂ ਕੱਪੜੇ ਮੰਗਾਉਣੇ ਪੈਂਦੇ ਹਨ ਵੈਸੇ ਤਾਂ ਮੈਂ ਇਸ ਨੂੰ ਇੱਕ ਵਧੀਆ ਫੀਡਬੈਕ ਦਵਾਂਗਾ ਪਰ ਕਿਤੇ ਨਾ ਕਿਤੇ ਇਸ ਵਿੱਚ ਕਮੀਆਂ ਹਾਲੇ ਵੀ ਹਨ ਇਸ ਕਰਕੇ ਇਹਨਾਂ ਓਨਲਾਈਨ ਦੁਕਾਨਦਾਰਾਂ ਨੂੰ ਇਸ ਵਿੱਚ ਸੁਧਾਰ ਕਰਨ ਦੀ ਬਹੁਤ ਬਹੁਤ ਜ਼ਰੂਰਤ ਹੈ ਅਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਕੱਪੜੇ ਧਿਆਨ ਨਾਲ ਹੀ ਲੈਣੇ ਓਨਲਾਈਨ ਧੰਨਵਾਦ